ਸਾਡੇ ਇਲਾਕੇ ਵਿੱਚ ਹੋ ਰਹੇ ਅਪਰਾਧ ਦਾ ਮੁੱਖ ਕਾਰਨ ਬੇਰੁਜ਼ਗਾਰੀ ਹੈ ਕਿਉਂਕਿ ਜਦੋਂ ਜੀਵ ਬੇਰੁਜ਼ਗਾਰ ਹੁੰਦਾ ਹੈ ਤਾਂ ਉਹਦੇ ਅੰਦਰ ਗਲਤ ਸੋਚ ਗਲਤ ਵਿਚਾਰਧਾਰਾ ਪ੍ਰਗਟ ਹੋਣ ਕਰਕੇ ਉਹ ਗਲਤ ਸੰਗਤ ਵਿੱਚ ਪੈ ਜਾਂਦਾ ਹੈ ਅਤੇ ਨਸ਼ੇ ਕਰਨ ਲੱਗ ਪੈਂਦਾ ਜਿਸ ਕਰਕੇ ਉਹ ਨਸ਼ੇ ਦੀ ਪੂਰਤੀ ਵਾਸਤੇ ਵੱਖ ਵੱਖ ਅਪਰਾਧ ਕਰਦਾ ਹੈ ਲੁੱਟਾ ਖੋਹਾਂ ਕਰਦਾ ਹੈ ਚੋਰੀਆਂ ਕਰਦਾ ਹੈ ਡਕੈਤੀਆਂ ਕਰਦਾ ਹੈ ਕਿਸੇ ਦੂਸਰੇ ਜੀਵ 'ਤੇ ਹਮਲਾ ਕਰਦਾ ਇਸ ਕਰਕੇ ਸਾਡੇ ਇਲਾਕੇ ਦੇ ਵਿੱਚ ਵੀ ਬਹੁਤ ਸਾਰਾ ਨਸ਼ਾ ਹੋਣ ਕਰਕੇ ਜੀਵ ਗਲਤ ਸੰਗਤ ਵਿੱਚ ਪੈਣ ਕਰਕੇ ਲੁੱਟਾਂ ਖੋਹਾਂ ਹੋਰ ਅਪਰਾਧ ਘਿਨੌਣੇ ਕਰ ਰਹੇ ਹਨ ਜਿਸ ਕਰਕੇ ਸਾਡੇ ਇਲਾਕੇ ਦੇ ਵਿੱਚ ਅਪਰਾਧ ਅਪਰਾਧੀਆਂ ਦੀ ਗਿਣਤੀ ਦਿਨੋ ਦਿਨ ਵਧ ਰਹੀ ਹੈ ਇਸ ਦਾ ਮੁੱਖ ਕਾਰਨ ਬੇਰੁਜ਼ਗਾਰੀ